ਮੈਂ ਧਾਤ ਦੀਆਂ ਬਣੀਆਂ ਵਾਲੀਆਂ ਦੇ ਬਾਰੇ ਗੱਲ ਕਰਨਾ ਚਾਹਵਾਂਗੀ ਜੋ ਕਿ ਮੈਂ ਮੇਲੇ ਦੇ ਵਿੱਚੋਂ ਖਰੀਦੀਆਂ ਸੀ ਉਹ ਧਾਤ ਦੀਆਂ ਵਾਲੀਆਂ ਦੀ ਜਿਹੜੀ ਸ਼ ਸ਼ੇਪ ਹੈਗੀ ਹੈ ਉਹ ਮੋ ਮੋਰ ਪੰਖ ਦੇ ਰੂਪ ਵਿੱਚ ਹੈ ਉਹ ਉਹ ਬਹੁਤ ਹਲਕੀ ਹੈ ਅਗਰ ਉਸਦੇ ਲਾਭ ਦੀ ਗੱਲ ਕੀਤੀ ਜਾਵੇ ਤਾਂ ਉਹ ਬਹੁਤ ਹਲਕੇ ਨੇ ਪਹਿਨਣ ਦੇ ਵਿੱਚ ਉਹਨਾਂ ਨੂੰ ਅਸੀਂ ਹਰ ਕਿਸੇ ਵੀ ਸਮੇਂ ਪਾ ਸਕਦੇ ਹਾਂ ਵਾਲੀਆਂ ਪਾਉਣ ਦੇ ਨਾਲ ਸਾਨੂੰ ਚਮੜੀ ਰੋਗ ਜਿਹੜੇ ਨੇ ਉਹਨਾਂ ਤੋਂ ਬਚਾਅ ਹੁੰਦਾ ਹੈ ਇਹ ਹਲਕੇ ਹੁੰਦੇ ਨੇ ਇਹਨਾਂ ਦਾ ਜਿਹੜਾ ਇਹ ਮੁੱਲ ਹੈ ਉਹ ਵੀ ਥੋੜ੍ਹਾ ਹੀ ਹੁੰਦਾ ਹੈ ਅਸੀਂ ਇਹਨਾਂ ਨੂੰ ਰੋਜ਼ ਪਾ ਸਕਦੇ ਹਾਂ ਅਤੇ ਇਹ ਸਾਨੂੰ ਬਹੁਤ ਸਾਰੇ ਰੂਪ ਦੇ ਵਿੱਚ ਬਹੁਤ ਸਾਰੀ ਸ਼ੇਪਸ ਦੇ ਵਿੱਚ ਡਿਜ਼ਾਇਨਸ ਦੇ ਵਿੱਚ ਮਿਲਦੇ ਹਨ